ਵੱਖ ਵੱਖ ਖੇਤਰਾਂ ਵਿੱਚ ਤਕਨੋਲਜੀ ਦੇ ਜਿਵੇਂ ਬਹੁਤ ਸਾਰੇ ਫ਼ਾਇਦੇ ਹਨ ਇਸ ਸੰਬੰਧ ਵਿੱਚ ਤਕਨੋਲਜੀ ਦੇ ਕੁਝ ਮੁੱਖ ਨੁਕਸਾਨ ਵੀ ਸਾਹਮਣੇ ਆ ਰਹੇ ਹਨ ਜਿਵੇਂ ਕਿ ਵਿਦਿਆਰਥੀ ਜਾਂ ਛੋਟੇ ਬੱਚੇ ਮੋਬਾਇਲ ਦੇ ਉੱਪਰ ਬਹੁਤ ਜ਼ਿਆਦਾ ਸਮਾਂ ਬਤੀਤ ਕਰਨ ਲੱਗ ਪਏ ਹਨ ਉਹ ਯੂਟਿਊਬ ਦੇ ਉੱਪਰ ਵੀਡੀਓਜ ਜਾਂ ਸੋਸ਼ਲ ਮੀਡੀਆ ਪਲੇਟਫੋਰਮ ਦੇ ਉੱਪਰ ਜੋ ਸ਼ੋਰਟਸ ਹੁੰਦੇ ਹਨ ਸ਼ੋਰਟ ਵੀਡੀਓਜ ਹਨ ਉਹਨਾਂ ਨੂੰ ਦੇਖੀ ਜਾਂਦੇ ਹਨ ਤਾਂ ਇਸ ਉੱਤੇ ਸਾਡੀ ਕੋਈ ਰੋਕ ਜਾਂ ਸਾਡੀ ਕੋਈ ਇਸ ਦੇ ਉੱਪਰ ਸਾਡਾ ਕੋਈ ਚੈੱਕ ਨਹੀਂ ਹੁੰਦਾ ਅਤੇ ਸਾਨੂੰ ਇਹ ਪਤਾ ਨਹੀਂ ਲੱਗਦਾ ਕਿ ਉੱਥੇ ਕਿਸ ਤਰੀਕੇ ਦਾ ਜੋ ਕੰਟੈਂਟ ਹੈ ਕਿਸ ਤਰ੍ਹਾਂ ਦੀ ਸਮੱਗਰੀ ਹੈ ਜੋ ਪਰੋਸੀ ਜਾ ਰਹੀ ਹੈ ਅਤੇ ਇਸ ਸਬੰਧੀ ਸਾਨੂੰ ਸੁਚੇਤ ਹੋਣ ਦੀ ਲੋੜ ਹੈ ਇਸ ਤੋਂ ਇਲਾਵਾ ਕਿਉਂਕਿ ਬਹੁਤ ਜ਼ਿਆਦਾ ਸਮਾਂ ਬੱਚੇ ਮੋਬਾਇਲ ਫੋਨ ਦੇ ਉੱਪਰ ਬਤੀਤ ਕਰਦੇ ਹਨ ਇਹਦੇ ਨਾਲ ਉਹਨਾਂ ਦੇ ਸਿਹਤ ਉੱਪਰ ਵੀ ਕਾਫ਼ੀ ਜ਼ਿਆਦਾ ਨੁਕਸਾਨਦਾਇਕ ਪ੍ਰਭਾਵ ਪੈ ਰਹੇ ਹਨ ਉਹਨਾਂ ਦੀ ਅੱਖਾਂ ਦੀ ਨਜ਼ਰ ਕਮਜ਼ੋਰ ਹੁੰਦੀ ਜਾ ਰਹੀ ਹੈ ਅਤੇ ਉਹਨਾਂ ਦੀ ਸਿਹਤ 'ਤੇ ਵੀ ਗਲਤ ਅਸਰ ਪੈ ਰਿਹਾ ਹੈ ਇਸ ਇਸ ਚੀਜ਼ ਨੂੰ ਰੋਕਣ ਦੇ ਲਈ ਸਾਨੂੰ ਵਿਦਿਆਰਥੀਆਂ ਨੂੰ ਜਾਂ ਬੱਚਿਆਂ ਨੂੰ ਹੋਰ ਵੱਖ ਵੱਖ ਗਤੀਵਿਧਿਆਂ ਦੇ ਵਿੱਚ ਵੀ ਹਿੱਸਾ ਲੈਣ ਦੇ ਲਈ ਜਿਵੇਂ ਕਿ ਖੇਡਾਂ ਅਤੇ ਹੋਰ ਵੱਖ ਵੱਖ ਘਰੇਲੂ ਗਤੀਵਿਧੀਆਂ ਦੇ ਵਿੱਚ ਸ਼ਾਮਿਲ ਹੋਣ ਲਈ ਵਿਦਿਆਰਥੀਆਂ ਨੂੰ ਸਾਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ ਜੀ